ਪੰਜਾਬ ਰਿਸ਼ੀਆਂ ਮੁਨੀਆਂ ਅਤੇ ਤਿਉਹਾਰਾਂ ਦੀ ਧਰਤੀ ਹੈ ਪੰਜਾਬ ਵਿੱਚ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ ਜਿਵੇਂ ਕਿ ਸਾਲ ਦੀ ਸ਼ੁਰੂਆਤ ਵਿੱਚ ਹੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਲੋਹੜੀ ਵਾਲੇ ਦਿਨ ਲੋਹੜੀ ਵਾਲੇ ਦਿਨ ਲੋਕ ਰੇੜੀਆਂ ਮੁੰਗਫ਼ਲੀ ਆਦਿ ਖਾਂਦੇ ਹਨ ਅਤੇ ਅੱਗ ਬਾਲਦੇ ਹਨ ਅਤੇ ਉਸ ਤੋਂ ਬਾਅਦ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਵਿਸਾਖੀ ਦੇ ਤਿਉਹਾਰ ਵਾਲੇ ਦਿਨ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਜਾਂਦੇ ਹਨ ਇਸ ਦਿਨ ਕਿਸਾਨ ਹ ਹਾੜੀ ਦੀ ਫਸਲ ਕੱਟ ਕੇ ਲਿਆਉਂਦੇ ਆ ਅਤੇ ਕ ਇਹ ਤਿਉਹਾਰ ਹਾੜੀ ਦੀ ਫਸਲ ਕੱਟ ਕੇ ਪੱਕ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਅਸੀਂ ਅਨੰਦਪੁਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਅਤੇ ਵਿਸਾਖੀ ਵਾਲੇ ਦਿਨ ਲੋਕ ਇਸ਼ਨਾਨ ਕਰਦੇ ਹਨ ਉਸ ਤੋਂ ਬਾਅਦ ਦਿਹਾਲੀ ਦਿਵਾਲੀ ਵੀ ਭਾ ਭਾਰਤ ਦਾ ਪ੍ਰਮੁੱਖ ਤਿਉਹਾਰ ਹੈ ਦਿਵਾਲੀ ਵਾਲੇ ਦਿਨ ਲੋਕ ਦਿਵਾਲੀ ਵਾਲੇ ਦਿਨ ਲੋਕ ਦੀਵੇ ਬਾਲਦੇ ਹਨ ਦਿਵਾਲੀ ਵਾਲੇ ਦਿਨ ਲੋਕ ਦੀਵੇ ਬਾਲਦੇ ਹਨ ਅਤੇ ਪਟਾਕੇ ਚਲਾਉਂਦੇ ਹਨ ਅਤੇ ਖਾਣਾ ਅਤੇ ਪਕਵਾਨ ਬਣਾਉਂਦੇ ਹਨ ਹੋਲੀ ਹੋਲੀ ਵਾਲੇ ਦਿਨ ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ ਹਨ ਅਤੇ ਹੋ ਹੋਲੀ ਦੇ ਵੱਖ ਵੱਖ ਰੰਗਾਂ ਨਾਲ਼ ਖੇਲਦੇ ਹਨ ਬਸੰਤ ਬਸੰ ਬਸੰਤ ਵਾਲੇ ਦਿਨ ਲੋਕ ਗੁਰੂ ਕਾ ਲਾਹੌਰ ਮੱਖਾ ਟੇਕਣ ਜਾਂਦੇ ਹਨ ਇਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਸੀ ਅ ਅਤੇ ਗੁਰੂ ਕਾ ਲਾਹੌਰ ਬਸੰਤ ਦਾ ਮੇਲਾ ਵੀ ਲੱਗਦਾ ਹੈ ਦੁਸਹਿਰੇ ਦੁਸਹਿਰਾ ਦੁਸਹਿਰੇ ਵਾਲੇ ਦਿਨ ਲੋਕ ਪਟਾਕੇ ਚਲ ਲੋਕ ਪਟਾਕੇ ਵੀ ਚਲਾਉਂਦੇ ਹਨ ਅਤੇ ਰਾਵਣ ਕੁੰਭਕਰਨ ਅਤੇ ਮੇਘਨਾਥ ਦਾ ਪੁਤਲਾ ਵੀ ਜਲਾਂਦੇ ਹਨ ਤਰ੍ਹਾਂ ਪੰਜਾਬ ਪੰਜਾਬ ਤਿਉਹਾਰਾਂ ਦੀ ਧਰ ਧਰਤੀ ਹੈ ਅਸੀਂ ਅਤੇ ਅਸੀਂ ਤਿਉਹਾਰ ਵਾਲੇ ਦਿਨ ਨਵੇਂ ਪਕਵਾਨ ਬਣਾਉਂਦੇ ਹਨ ਨਵੇਂ ਕੱਪੜੇ ਪਾਉਂਦੇ ਹਨ ਤਿਉਹਾਰਾਂ ਵਿੱਚ ਲੜੀਆਂ ਲੜੀਆਂ ਵਗੈਰਾ ਲਾਉਂਦੇ ਹਨ ਘਰ ਦੀ ਡੈਕੋਰੇਸ਼ਨ ਦਿਵਾਲੀ ਵਿੱਚ ਅਸੀਂ ਮਤਲਬ ਘਰ ਦੀ ਸਾਫ਼ ਸਫ਼ਾਈ ਕਰਦੇ ਹਨ